ਮੈਂ ਸਕੂਲਾਂ ਬਾਰੇ ਦੱਸਾਂਗੀ ਸਰਕਾਰੀ ਸਕੂਲ ਦੇ ਬਹੁਤ ਅੱਛਾ ਰਿਜੈਲਟ ਹੈ ਲੇਕਿਨ ਸਰਕਾਰੀ ਸਕੂਲ ਵਿੱਚ ਕੋਈ ਵੀ ਰਿਲਾਏ ਵਗੈਰਾ ਨਹੀਂ ਹੈ ਫੀਸ ਘੱਟ ਹੈ ਬੱਚੇ ਦੀ ਪੜ੍ਹਾਈ ਅੱਛੀ ਨਹੀਂ ਹੈ ਅਸੀਂ ਆਪਣੇ ਬੱਚਿਆਂ ਨੂੰ ਅੱਛੀ ਪੜ੍ਹਾਈ ਦੇਣਾ ਚਾਹੰਦੇ ਹਾਂ ਅਤੇ ਜੇ ਅਸੀਂ ਪ੍ਰਾਈਵੇਟ 'ਚ ਬੱਚਿਆਂ ਨੂੰ ਪੜ੍ਹਾਈਏ ਤਾਂ ਉੱਥੇ ਪੜ੍ਹਾਈ ਅੱਛੀ ਹੈ ਖਰਚੇ ਬਹੁਤ ਜ਼ਿਆਦਾ ਹੈ ਜਿਹੜੇ ਗਰੀਬ ਮਾਂ ਬਾਪ ਹੈ ਉਹ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਅਤੇ ਅੱਗੇ ਸਰਕਾਰੀ ਸਕੂਲ ਅੱਛੇ ਨੇ ਲੇਕਿਨ ਉੱਥੇ ਲਾਇਬ੍ਰੇਰੀ ਵਗੈਰਾ ਕੁਛ ਨਹੀਂ ਹੈ ਅਤੇ ਆਪਣੇ ਸਰ ਸਰਕਾਰੀ ਹੋਸਪਿਟਲ ਵਗੈਰਾ ਵੋ ਵੀ ਸਾਡੇ ਰੋਪੜ ਵਿੱਚ ਬਹੁਤ ਵਧੀਆ ਨੇ ਅਸੀਂ ਉਹਨਾਂ ਬਾਰੇ ਵੀ ਦੱਸਦੇ ਬਹੁਤ ਸਾਨੂੰ ਜਾਣਕਾਰੀ ਦਿੰਦੇ ਨੇ ਕਿ ਘੱਟ ਖਰਚੇ 'ਚ ਆਪਣੀ ਆਪਣੀ ਸਲਿੱਪ ਲੈ ਕੇ ਅਸੀਂ ਦਵਾਈ ਵਗੈਰਾ ਲੈ ਸਕਦੇ ਸਰਕਾਰੀ ਹੋਸਪਿਟਲ 'ਚ ਆਪਾਂ ਨੂੰ ਬਹੁਤ ਫਾਇਦੇ ਨੇ ਪ੍ਰਾਈਵੇਟਾਂ 'ਚ ਪਹਿਲੇ ਪਰਚੀ ਦੋ ਸੌ ਰੁਪਇਆ ਪਰਚੀ ਕਟਵਾਓ ਦਵਾਈ ਲਉ ਆਪਾਂ ਦਵਾਈ ਨਾਲ ਕਿੰਨ੍ਹੇ ਆਪਾਂ ਹਜ਼ਾਰ ਰੁਪਏ ਆਪਣੇ ਗਰੀਬ ਬੰਦਾ ਨਹੀਂ ਆਪਣਾ ਲੈ ਸਕਦਾ ਜੀ